ਟਰੈਕਟਰ ਦੀਆਂ ਕਾਫ਼ੀਆਂ ਸਾਰੀਆਂ ਕਿਸਮਾਂ ਅਤੇ ਬ੍ਰੈਂਡ ਹਨ ਜੋ ਕਿ ਮੈਂ ਦੇਖੇ ਹਨ ਪਰ ਤੁਹਾਨੂੰ ਅੱਜ ਮੈਂ ਸਵਰਾਜ ਟਰੈਕਟਰ ਬਾਰੇ ਦੱਸਣ ਜਾ ਰਿਹਾ ਹਾਂ ਇਹ ਟਰੈਕਟਰ ਦੀ ਕਿਸਮ ਹੈ ਇਸ ਟਰੈਕਟਰ ਦੀ ਹੁਣ ਤੱਕ ਬਹੁਤ ਹੀ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ ਇਹ ਜ਼ਿਆਦਾਤਰ ਪਿੰਡਾਂ ਵਿੱਚ ਲੋਕਾਂ ਦੁਆਰਾ ਇਸਦੀ ਹੀ ਖਰੀਦ ਕੀਤੀ ਜਾਂਦੀ ਹੈ ਇਹ ਟਰੈਕਟਰ ਬਹੁਤ ਹੀ ਜ਼ਿਆਦਾ ਸਰਲ ਤਰੀਕੇ ਨਾਲ਼ ਖੇਤੀ ਕਰਨ ਵਿੱਚ ਮਦਦ ਕਰਦਾ ਹੈ ਇਹ ਟਰੈਕਟਰ ਇੱਕ ਜਾਇਜ਼ ਰੁਪਿਆਂ ਵਿੱਚ ਮਿਲ ਸਕਦਾ ਹੈ ਕਿਉਂਕਿ ਰਵਾਇਤੀ ਢੰਗ ਵਿੱਚ ਬਹੁਤ ਸਮਾਂ ਲੱਗਦਾ ਹੈ ਖੇਤੀ ਕਰਨ ਲਈ ਪਰ ਸਵਰਾਜ ਟਾਈ ਟਰੈਕਟਰ ਰਾਹੀਂ ਅਸੀਂ ਛੇਤੀ ਤੋਂ ਅਤੇ ਵਧੀਆ ਤਰੀਕੇ ਨਾਲ਼ ਖੇਤੀ ਕਰ ਸਕਦੇ ਹਾਂ ਅਤੇ ਵਧੀਆ ਅਨਾਜ ਪੈਦਾ ਕਰ ਸਕਦੇ ਹਾਂ